ਸਤਿ ਸ਼੍ਰੀ ਅਕਾਲ ਜੀ ਮੈਂ ਭਾਵੀਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਜਿਵੇਂ ਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਭੋਜਨ ਪਕਾਉਣ ਦਾ ਬਹੁਤ ਸ਼ੌਂਕ ਹੈ ਵੈਸੇ ਤਾਂ ਮੈਂ ਹਰ ਤਰ੍ਹਾਂ ਦਾ ਭੋਜਨ ਬਣਾ ਲੈਂਦੀ ਹਾਂ ਪਰ ਮੈਨੂੰ ਦੱਖਣੀ ਭਾਰਤ ਦੀ ਇਡਲੀ ਅਤੇ ਡੋਸਾ ਬਣਾਉਣਾ ਬਹੁਤ ਜ਼ਿਆਦਾ ਪਸੰਦ ਹੈ ਜੋ ਕਿ ਮੈਂ ਇੰਟਰਨੈੱਟ ਤੋਂ ਯੂਟੀਊਬ ਤੋਂ ਸਿੱਖਿਆ ਸੀ ਉਸ ਦੇ ਨਾਲ ਮੈਂ ਨਾਰੀਅਲ ਦੀ ਚਟਣੀ ਅਤੇ ਸਾਂਬਰ ਬਣਾਉਣਾ ਵੀ ਯੂਟੀਊਬ ਤੋਂ ਹੀ ਸਿੱਖਿਆ ਹੈ ਪਹਿਲੀ ਵਾਰ ਤਾਂ ਉਹ ਇੰਨਾ ਵਧੀਆ ਨਹੀਂ ਸੀ ਬਣਿਆ ਪਰ ਮੈਂ ਹੁਣ ਜਦੋਂ ਉਸਨੂੰ ਦੂਸਰੀ ਵਾਰ ਬਣਾਇਆ ਤਾਂ ਉਹ ਬਹੁਤ ਸਵਾਦ ਬਣਿਆ ਸੀ ਉਹ ਹੁਣ ਮੇਰੇ ਸਾਰੇ ਪਰਿਵਾਰ ਨੂੰ ਵੀ ਬਹੁਤ ਸਵਾਦ ਲੱਗਦਾ ਹੈ ਧੰਨਵਾਦ